ਮੈਂ ਵਿਜੇ ਗੁਰਦਾਸਪੁਰ ਜਿਲੇ ਦਾ ਵਾਸੀ ਹਾਂ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਸਾਡੇ ਦੇਸ਼ ਵਿੱਚ ਕੀ ਪੂਰੀ ਦੁਨੀਆਂ ਵਿੱਚ ਮੀਡੀਆ ਇੱਕ ਅਜਿਹੀ ਅਜਿਹਾ ਥੰਮ ਹੈ ਜਿਸ ਨੂੰ ਅਸੀਂ ਕਹਿ ਦਈਏ ਇਹ ਲੋਕਤੰਤਰ ਦਾ ਚੌਥਾ ਥਮ ਹੈ ਤਾਂ ਕਦੀ ਵੀ ਝੂਠ ਨਹੀਂ ਹੋਵੇਗਾ ਕਿਉਂਕਿ ਮੀਡੀਆ ਤੋਂ ਹੀ ਸਾਨੂੰ ਦੇਸ਼ ਦੀ ਦੁਨੀਆਂ ਦੀ ਜਾਂ ਆਸੇ ਪਾਸੇ ਦੀ ਕੋਈ ਵੀ ਖਬਰ ਬਾਰੇ ਪਤਾ ਲੱਗਦਾ ਹੈ ਤਰੱਕੀ ਬਾਰੇ ਪਤਾ ਲੱਗਦਾ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਸਾਡੇ ਸਮਾਜ ਵਿੱਚ ਮੀਡੀਆ ਇੱਕ ਅਜਿਹੀ ਚੀਜ਼ ਹੈ ਜਾਂ ਇਰ ਥ ਇਹ ਸਮਾਜ ਵਿੱਚ ਅਜਿਹੀ ਇਸਨੇ ਥਾਂ ਬਣਾ ਲਈ ਹੈ ਕਿ ਜੋ ਸਾਨੂੰ ਸਵੇਰ ਤੋਂ ਸ਼ਾਮ ਤੱਕ ਅਨੇਕਾਂ ਤਰ੍ਹਾਂ ਦੀਆਂ ਅਜਿਹੀਆਂ ਖਬਰਾਂ ਜੋ ਕਿ ਸਾਡੇ ਆਸੇ ਪਾਸੇ ਦੂਰ ਦੁਰਾਡੇ ਜਾਂ ਬਾਹਰ ਦੀ ਦੁਨੀਆਂ ਵਿੱਚ ਵਾਪਰਦੀਆਂ ਹਨ ਉਹਨਾਂ ਦਾ ਬਿਊਰਾ ਦਿੰਦਾ ਹੈ ਜੇਕਰ ਅਸੀਂ ਅੱਜ ਇਸ ਚੈਨਲ ਆਜ ਤੱਕ ਦੀ ਗੱਲ ਕਰੀਏ ਕਿ ਸੁਧੀਰ ਚੌਧਰੀ ਜੋ ਕਿ ਰਾਤੀ ਰਾਤ ਨੌ ਤੋਂ ਦਸ ਵਜੇ ਦੇ ਵਿੱਚ ਬਲੈਕ ਐਂਡ ਵਾਈਟ ਲੈ ਕੇ ਆਉਂਦੇ ਹਨ ਉਹ ਸਾਨੂੰ ਬੜੀ ਵਧੀਆ ਤੇ ਜੱਥਾ ਯੋਗ ਖਬਰਾਂ ਦੱਸਦੇ ਹਨ ਜੋ ਕਿ ਸਾਡੇ ਲਈ ਕਦੀ ਵੀ ਨਾ ਸੁਣਨ ਵਾਲੀਆਂ ਹੁੰਦੀਆਂ ਹਨ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅੱਜ ਮੀਡੀਆ ਨੇ ਆਪਣੀ ਬੜੀ ਵਧੀਆ ਥਾਂ ਬਣਾ ਲਈ ਹੈ ਜੋ ਕਿ ਦੁਨੀਆਂ ਦੀਆਂ ਜਾਂ ਸਾਡੇ ਦੇਸ਼ ਦੀਆਂ ਅਹਿਮ ਤੋਂ ਅਹਿਮ ਜੇਕਰ ਅਸੀਂ ਰਾਜਨੀਤੀ ਖੇਲ ਸਿੱਖਿਆ ਜਾਂ ਹੋਰ ਕਿਸੇ ਖੇਤਰ ਦੀ ਗੱਲ ਕਰੀਏ ਤਾਂ ਉਹ ਸਾਨੂੰ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੰਦੇ ਹਨ ਤੇ ਉਹਨਾਂ ਨੇ ਆਪਣੀ ਬੜੀ ਵਧੀਆ ਭੂਮਿਕਾ ਖੜੀ ਕਰ ਲਈ ਹੈ ਧੰਨਵਾਦ